ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਮੈਮ ਰਾਜਿੰਦਰਾ ਹੋਸਪਿਟਲ ਤੋਂ ਬੋਲ ਰਹੇ ਹਾਂ ਮੈਮ ਇੱਥੇ ਚੌਵੀ ਘੰਟੇ ਐਮਰਜੰਸੀ ਦੀ ਫੈਸਿਲਿਟੀ ਅਵੇਲੇਬਲ ਹੈ ਠੀਕ ਹੈ ਜੀ ਸਾਰੇ ਵਿਭਾਗਾਂ ਦੇ ਡਾਕਟਰ ਜਿਹੜੇ ਹੈਗੇ ਨੇ ਚਾਹੇ ਔਰਥੋ ਹੋਵੇ ਚਾਹੇ ਗਾਈਨੀ ਹੋਵੇ ਚਾਹੇ ਯੂਰੋਲੋਜੀ ਹੋਵੇ ਸਰਜਰੀ ਉਹ ਚੌਵੀ ਘੰਟਿਆਂ ਦੇ ਵਿੱਚ ਇੱਕ ਡਾਕਟਰ ਹਮੇਸ਼ਾਂ ਹਰ ਵਿਭਾਗ ਦਾ ਅਵੇਲੇਬਲ ਰਹਿੰਦਾ ਅਤੇ ਇੱਥੇ ਬੈਡ ਬੈਡ ਹੈਗੇ ਨੇ ਬੈਡ ਦਾ ਰੈਂਟ ਬਿਲਕੁਲ ਨਹੀਂ ਆ ਅਤੇ ਪੇਸ਼ੈਂਟਸ ਲਈ ਫੂਡ ਵੀ ਅਵੇਲੇਬਲ ਕਰਵਾਇਆ ਜਾਂਦਾ ਗਰੀਬ ਪੇਸ਼ੈਂਟਸ ਲਈ ਇੱਥੇ ਮੈਡੀਸਨਜ਼ ਵੀ ਅਵੇਲੇਬਲ ਕਰਵਾਈਆਂ ਜਾਂਦੀਆਂ ਨੇ ਜੋ ਕਿ ਤੁਹਾਨੂੰ ਪਤਾ ਹੋਵੇਗਾ ਵੀ ਆਪਣਾ ਜਿਹੜਾ ਮੋਦੀ ਸਾਹਿਬ ਦਾ ਸਕੀਮ ਏ ਜਿਹੜੀ ਆਯੁਸ਼ਮਾਨ ਕਾਰਡ ਉਹ ਰਾਜਿੰਦਰਾ ਦੇ ਵਿੱਚ ਸ਼ੁਰੂ ਕਰਵਾ ਕੇ ਤੁਹਾਨੂੰ ਮੈਡੀਸਨ ਵਗੈਰਾ ਬਿਲਕੁਲ ਫਰੀ ਮਿਲਦੀਆਂ ਨੇ ਇਲਾਜ ਬਿਲਕੁਲ ਫਰੀ ਹੁੰਦਾ ਕੋਈ ਫੀਸ

ਨਹੀਂ ਮੈਮ ਬਿਲਕੁਲ ਕੋਈ ਚਾਰਜਿਸ ਨਹੀਂ ਹੈਗੇ ਜਿਹੜੀ ਡਾਕਟਰ ਨੂੰ ਦਿਖਾਉਣ ਦੀ ਫੀਸ ਹੈ ਸਿਰਫ ਦਸ ਰੁਪਏ ਦੀ ਸਲਿੱਪ ਲੈਣੀ ਪੈਂਦੀ ਹੈ ਅਤੇ ਓ ਹਾਂਜੀ ਉਹ ਸ਼ੁਰੂ ਹੋ ਜਾਂਦੀ ਹੈ ਅਤੇ ਜੇ ਤੁਸੀਂ ਓਪ ਹਾਂਜੀ ਮੈਮ ਮੈਂ ਮੈਡੀਸਨ ਡਿਪਾਰਟਮੈਂਟ ਤੋਂ ਬੋਲ ਰਹੀ ਹਾਂ ਮੈਮ ਮੈਡੀਸਨ ਦੀ ਗੱਲ ਇਹ ਹੈ ਜੀ ਵੈਸੇ ਤਾਂ ਹੈ ਅਤੇ ਅਦਰਵਾਈਜ਼ ਮੈਡੀਸਨ ਜਿਹੜੀਆਂ ਸਰਕਾਰ ਵੱਲੋਂ ਆਉਂਦੀਆਂ ਨੇ ਬਹੁਤੀਆਂ ਜ਼ਿਆਦਾ ਮੈਡੀਸਨਜ਼ ਜਿਹੜੀਆਂ ਹੈਗੀਆਂ ਨੇ ਅਵੇਲੇਬਲ ਹੁੰਦੀਆਂ ਨੇ ਓਪੀਡੀ 'ਚ ਦਿਖਾਉਣ ਤੋਂ ਬਾਅਦ ਉਹ ਮੈਡੀਸਨ ਤੁਹਾਨੂੰ ਮਿਲ ਜਾਂਦੀਆਂ ਨੇ ਅਤੇ ਜੋ ਇੱਕ ਅੱਧੀ ਨਾ ਵੀ ਮਿਲੇ ਤਾਂ ਜਨ ਔਸ਼ਧੀ 'ਚ ਬਹੁਤ ਘੱਟ ਰੇਟ 'ਚ ਮਿਲ ਜਾਂਦੀਆਂ ਨੇ ਜਨ ਔਸ਼ਧੀ ਵੀ ਰਜਿੰਦਰਾ ਦੇ ਅੰਦਰ ਹੀ ਅਵੇਲੇਬਲ ਹੈ

ਓਕੇ ਓਕੇ